ਸਤਿ ਸ਼੍ਰੀ ਅਕਾਲ ਸਾਰੇ ਜਣਿਆਂ ਨੂੰ ਮੈਂ ਥੋਡੇ ਸਾਰੇ ਸਾਰੇ ਜਣਿਆਂ ਦੇ ਨਾਲ ਇਸ ਵਕਤ ਤਕਨੀਕੀ ਹੁਨਰ ਦੀ ਗੱਲ ਕਰਨ ਜਾ ਰਿਹਾ ਹਾਂ ਜਿਹਦੇ ਨਾਲ ਸਾਡਾ ਜਿਹੜਾ ਵਾ ਉਹ ਆਪਾਂ ਤਕਨੀਕੀ ਹੁਨਰ ਨੂੰ ਪ੍ਰਾਪਤ ਕਰਕੇ ਆਪਾਂ ਆਪਣੇ ਹੀ ਜੀਵਨ ਦੇ ਵਿੱਚ ਕਿਸ ਤਰ੍ਹਾਂ ਅਸੀਂ ਅੱਗੇ ਤਰੱਕੀ ਤਰੱਕੀ ਦੇ ਰਾਹ 'ਤੇ ਜਿਹੜਾ ਵਾ ਉਹ ਅੱਗੇ ਵਧ ਸਕਦੇ ਹਾਂ ਇਹਦੇ ਵਿੱਚ ਤਕਨੀਕੀ ਹੁਨਰ ਜਿਹੜਾ ਵਾ ਉਹ ਕਈ ਤਰ੍ਹਾਂ ਦਾ ਤਕਨੀਕੀ ਹੁਨਰ ਆ ਜਾਂਦਾ ਵਾ ਇੱਕ ਬੰਦਾ ਵਾ ਜਿਹੜਾ ਵਾ ਉਹ ਇੱਕ ਤੋਂ ਵੱਧ ਵੀ ਤਕਨੀਕੀ ਹੁਨਰ ਜਿਹੜਾ ਵਾ ਉਹ ਪ੍ਰਾਪਤ ਕਰ ਸਕਦਾ ਵਾ ਤਕਨੀਕੀ ਹੁਨਰ ਦੇ ਵਿੱਚ ਮੈਂ ਦੱਸਣਾ ਚਾਹਾਂਗਾ ਜਿਸ ਤਰ੍ਹਾਂ ਜਿਹੜਾ ਵਾ ਲੱਕੜਹਾਰਾ ਇੱਕ ਹੁੰਦਾ ਵਾ ਉਹ ਆਪਣੇ ਲੱਕੜ ਦੇ ਕੰਮ ਦੇ ਵਿੱਚ ਜਿਹੜਾ ਵਾ ਬਹੁਤ ਹੀ ਮਾਹਿਰ ਹੁੰਦਾ ਵਾ ਉਹ ਜਿਹੜਾ ਵਾ ਉਹ ਜਿਹੜਾ ਕੰਮ ਉਹਨੇ ਕਰ ਲੈਣਾ ਵਾ ਉਹ ਕੋਈ ਵੀ ਕੰਮ ਹੋਰ ਨਹੀਂ ਹੈਗਾ ਕਰ ਸਕਦਾ ਇਸ ਤਰ੍ਹਾਂ ਦੇ ਕੰਮਾਂ ਨੂੰ ਆਪਾਂ ਤਕਨੀਕੀ ਹੁਨਰ ਜਿਹੜਾ ਕਹਿੰਦੇ ਹਾਂ ਇਸ ਤਰ੍ਹਾਂ ਦਾ ਕੰਮ ਕਰਕੇ ਕੋਈ ਵੀ ਜਿਹੜਾ ਵਾ ਬੰਦਾ ਵਾ ਆਪਣਾ ਜਿਹੜਾ ਵਾ ਰੋਜ਼ ਜਿਹੜਾ ਵਾ ਨਿੱਜੀ ਜੀਵਨ ਦਾ ਜਿਹੜਾ ਵਾ ਡੇਲੀ ਦਾ ਜਿਹੜਾ ਖਰਚਾ ਜਿਹੜਾ ਵਾ ਉਹ ਆਪਣੇ ਜੀਵਨ ਜਿਊਣ ਦੇ ਲਈ ਜਿਹੜੀ ਬਹੁਤ ਹੀ ਜ਼ਰੂਰੀ ਹੁੰਦਾ ਵਾ ਉਹ ਖਰਚਾ ਜਿਹੜਾ ਵਾ ਉਹ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਜਿਹੜਾ ਵਾ ਉਹ ਜ਼ਿੰਦਗੀ ਜਿਹੜੀ ਹੈ ਉਹ ਬਤੀਤ ਕਰ ਸਕਦਾ ਵਾ ਬਾਕੀ ਹੋਰ ਵੀ ਤਕਨੀਕੀ ਹੁਨਰ ਜਿਹੜੇ ਹੈ ਇਹਦੇ ਵਿੱਚ ਹੁੰਦੇ ਹੈ ਜਿਹਦੇ ਵਿੱਚ ਮੈਂ ਗੱਲ ਕਰਨਾ ਚਾਹਾਂਗਾ ਪੀ ਕੋਈ ਮਸ਼ੀਨ ਜਿਹੜੀ ਹੈ ਮਸ਼ੀਨਰੀ ਜਿਹੜੀ ਆ ਉਹ ਤਕਨੀਕੀ ਸਿੱਖਿਆ ਦੇ ਵਿੱਚ ਆ ਜਾਂਦੀ ਆ ਇਸ ਤੋਂ ਇਲਾਵਾ

ਕੰਪਿਊਟਰ ਦੇ ਵਿੱਚ ਆਪਾਂ ਕਈ ਇਹੋ ਜਿਹੇ ਸੋਫਟਵੇਅਰ ਜਿਹੜੇ ਕਿ ਡਿਵੈਲਪਮੈਂਟ ਸੋਫਟਵੇਅਰ ਡਿਵੈਲਪਮੈਂਟ ਕਰਨੀ ਜਾਂ ਸੋਫਟਵੇਅਰ ਨਾਲ ਬਣਾਉਣਾ ਇਹੋ ਜਿਹੀਆਂ ਚੀਜ਼ਾਂ ਨੂੰ ਬਣਾਉਣਾ ਜਿਹਦੇ ਨਾਲ ਸਾਡੇ ਜਿਹੜੇ ਜ਼ਿੰਦਗੀ ਦੇ ਵਿੱਚ ਜਿਹੜਾ ਵਾ ਉਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਿਹੜਾ ਵਾ ਉਹ ਵਾਧਾ ਹੋਵੇ ਡਾਟਾ ਲਰਨਿੰਗ ਡਾਟਾ ਸਾਇੰਸ ਵਗੈਰਾ ਕੋਈ ਇਹੋ ਜਿਹੀ ਕੋਡਿੰਗ ਡੀਕੋਡਿੰਗ ਕਰਨੀ ਕੰਪਿਊਟਰ ਦੇ ਵਿੱਚ ਜਿਸ ਦੇ ਨਾਲ ਜਿਹੜਾ ਵਾ ਉਹ ਓਵਰਆਲ ਜਿਹੜੀ ਆ ਉਹ ਇਹੋ ਜਿਹਾ ਕੋਈ ਸੋਫਟਵੇਅਰ ਤਿਆਰ ਕਰੇ ਜਿਹਦੇ ਨਾਲ ਜਿਹੜਾ ਵਾ ਉਹ ਬਹੁਤ ਸਾਰੇ ਲੋਕਾਂ ਨੂੰ ਜਿਹੜਾ ਵਾ ਉਹਦਾ ਫਾਇਦਾ ਹੋਵੇ ਰੁਜ਼ਗਾਰ ਮਿਲੇ ਉਸ ਚੀਜ਼ ਦੇ ਨਾਲ ਇਹੋ ਜਿਹੀਆਂ ਅਸੀਂ ਚੀਜ਼ਾਂ ਜਿਹੜੀਆਂ ਵਾ ਆਪਣੀ ਜ਼ਿੰਦਗੀ ਦੇ ਵਿੱਚ ਜਿਹੜੀਆਂ ਵਾ ਉਹ ਸਿੱਖ ਸਕਦੇ ਹਾਂ ਅਤੇ ਉਹਦੇ ਨਾਲ ਜਿਹੜਾ ਆਪਣੀ ਜ਼ਿੰਦਗੀ ਬਤੀਤ ਕਰ ਸਕਦੇ ਹਾਂ